ਹੈਲੋ ਸਤਿ ਸ਼੍ਰੀ ਅਕਾਲ ਜੀ ਰੈਪੀਟੋ 'ਤੇ ਗੱਲ ਕਰ ਰਹੇ ਹੋਂ ਮੈਂ ਤੁਹਾਡੇ ਤੋਂ ਇੱਕ ਟੈਕਸੀ ਬੁੱਕ ਕੀਤੀ ਸੀ ਸੱਤ ਵਜੇ ਦਾ ਟਾਈਮ ਸੀ ਪਰ ਤੁਹਾਡਾ ਬੰਦਾ ਹਜੇ ਤੱਕ ਨਹੀਂ ਪਹੁੰਚਿਆ ਮੇਰਾ ਅੱਜ ਦਾ ਪੇਪਰ ਸੀ ਜੋ ਕਿ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਟਾਈਮ 'ਤੇ ਪਹੁੰਚਾਂ ਅਤੇ ਰਸਤੇ ਵਿੱਚ ਮੇਰੇ ਕੁਝ ਦੋਸਤ ਵੀ ਮੇਰੀ ਵੇਟ ਕਰ ਰਹੇ ਹਨ ਜੋ ਕਿ ਮੇਰੇ ਨਾਲ ਹੀ ਇਸ ਟੈਕਸੀ ਵਿੱਚ ਜਾਣੇ ਸਨ ਅਤੇ ਸਾਡਾ ਕੁਝ ਪਲੈਨ ਸੀ ਕਿ ਅਸੀਂ ਰਸਤੇ ਵਿੱਚ ਜਾ ਕੇ ਕਿਤੇ ਵਧੀਆ ਜਗ੍ਹਾ ਜਗ੍ਹਾ 'ਤੇ ਘੁੰਮੀਏ ਪਰ ਤੁਹਾਡੇ ਡਰਾਈਵਰ ਨੇ ਸਾਨੂੰ ਲੇਟ ਕਰਾ ਦਿੱਤਾ ਹੈ ਅਤੇ ਮੈਂ ਟਾਈਮ ਸਿਰ ਆਪਣੇ ਪੇਪਰ 'ਤੇ ਵੀ ਨਹੀਂ ਪਹੁੰਚ ਸਕਦਾ ਅਤੇ ਰਸਤੇ ਵਿੱਚ ਬਹੁਤ ਜ਼ਿਆਦਾ ਜ਼ਾਮ ਵੀ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਟਰੈਫਿਕ ਅਤੇ ਚੰਡੀਗੜ੍ਹ ਵਿੱਚ ਤਾਂ ਵੈਸੇ ਵੀ ਬਹੁਤ ਜ਼ਿਆਦਾ ਲਾਈਟਾਂ ਹੁੰਦੀਆਂ ਹਨ ਜਿਸ ਕਾਰਨ ਮੈਂ ਆਪਣੇ ਪੇਪਰ 'ਤੇ ਟਾਈਮ ਸਿਰ ਨਹੀਂ ਪਹੁੰਚ ਸਕਦਾ ਸੋ ਕਿਰਪਾ ਕਰਕੇ ਤੁਸੀਂ ਆਪਣੇ ਡਰਾਈਵਰ ਨੂੰ ਕਹੋ ਕਿ ਉਹ ਜਲਦੀ ਆਵੇ ਅਤੇ ਜਲਦੀ ਪਹੁੰਚੇ ਸਾਡੇ ਦਿੱਤੇ ਹੋਏ ਪਤੇ 'ਤੇ ਤਾਂ ਜੋ ਮੈਂ ਆਪਦੇ ਪੇਪਰ ਵਿੱਚ ਪਹੁੰਚ ਸਕਾਂ ਧੰਨਵਾਦ